ਪੰਜਾਬੀ ਲੋਕ ਆਪਣੀ ਪਛਾਣ ਅਤੇ ਸੰਬੰਧਿਤ ਦੀ ਭਾਵਾਂ ਨੂੰ ਪ੍ਰਗਟ ਕਰਨ ਲਈ ਮਾਂ ਬੋਲੀ ਪੰਜਾਬੀ ਦੀ ਵਰਤੋਂ ਕਰਦੇ ਹਨ ਅਤੇ ਪਹਿਰਾਵੇ ਦੀ ਵਰਤੋਂ ਕਰਦੇ ਹਨ ਇਸ ਤੋਂ ਇਲਾਵਾ ਕਲਾਕਾਰ ਗੀਤਾਂ ਰਾਹੀਂ ਆਪਣੇ ਪਛਾਣ ਅਤੇ ਸੰਬੰਧਿਤ ਦੀ ਭਾਵਨਾ ਨੂੰ ਪ੍ਰਗਟ ਕਰਦੇ ਹਨ ਅਤੇ ਇਤਿਹਾਸਕਾਰ ਢਾਡੀ ਵਾਰਾ ਰਾਹੀਂ ਆਪਣੀ ਪਛਾਣ ਅਤੇ ਸੰਬੰਧ ਭਾਵਾਂ ਨੂੰ ਪ੍ਰਗਟ ਕਰਦੇ ਹਨ